ਦੋਸਤਾਂ ਮਿੱਤਰਾਂ ਨਾਲ ਮੈਨੂੰ ਆਪਣਾ ਘੁੰਮਣਾ ਫਿਰਨਾ ਬਹੁਤ ਪਸੰਦ ਲੱਗਦਾ ਹੈ ਅਤੇ ਅਸੀਂ ਇਕੱਠੇ ਬਹਿ ਕੇ ਕਈ ਵਾਰੀ ਪਾਰਟੀ ਕਰਦੇ ਹਾਂ ਖਾਣ ਪੀਣ ਦੀ ਜਾਂ ਕੁਛ ਹੋਰ ਐਰਾ ਵਗੈਰਾ ਘੁੰਮਣ ਦੀ ਜਦੋਂ ਅਸੀਂ ਕਿਤੇ ਘੁੰਮਣ ਫਿਰਨ ਜਾਂਦੇ ਹਾਂ ਅਤੇ ਵਧੀਆ ਇੱਕ ਦੂਜੇ ਨਾਲ ਰਚ ਮਿਚ ਜਾਂਦੇ ਹਾਂ ਤਾਂ ਜੋ ਅਸੀਂ ਇੱਕ ਦੂਜੇ ਦੀਆਂ ਦਿਲ ਦੀਆਂ ਗੱਲਾਂ ਕਰ ਸਕੀਏ ਅਤੇ ਉੱਥੇ ਹਾਸਾ ਮਖੌਲ ਕਰ ਸਕੀਏ ਇੱਕ ਦੂਜੇ ਨਾਲ ਤਾਂ ਜੋ ਵਧੀਆ ਦਿਲ ਖੁਸ਼ ਹੋ ਜਾਵੇ ਸਾਡਾ ਅਤੇ ਓ ਜੇ ਅਸੀਂ ਆਪਣਾ ਫੈਮਿਲੀ ਨਾਲ ਮਨਾਉਂਦੇ ਹਾਂ ਫੈਮਿਲੀ ਨਾਲ ਇਕੱਠੇ ਬਹਿ ਕੇ ਕਦੇ ਟੀ ਵੀ ਦੇਖ ਲਿਆ ਜਾਂ ਕੁਛ ਬਣਾ ਲਿਆ ਖਾਣ ਪੀਣ ਵਗੈਰਾ ਅਸੀਂ ਇਕੱਠੇ ਬਹਿ ਕੇ ਇੱਕ ਦੂਜੇ ਨਾਲ ਸਮਝੋ ਹਾਸਾ ਮਜ਼ਾਕ ਕਰਦੇ ਰਹਿੰਦੇ ਹਾਂ ਤਾਂ ਜੋ ਇੱਕ ਵਧੀਆ ਪਰਿਵਾਰ ਦਾ ਦਿਲ ਖੁਸ਼ ਹੋ ਜੇ ਤਾਂ ਜੋ ਕਿਸੇ ਦਿਲ 'ਚ ਕੁਛ ਵੀ ਇੱਦਾਂ ਦਾ ਮਹਿਸੂਸ ਨਾ ਹੋਵੇ ਕਿ ਸਾਡਾ ਪਰਿਵਾਰ ਅਲੱਗ ਅਲੱਗ ਹੈ ਅਤੇ ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਕਦੇ ਅਸੀਂ ਘੁੰਮਣ ਚਲੇ ਗਏ ਆਪਣਾ ਪਰਿਵਾਰ ਨਾਲ ਅਤੇ ਉੱਥੇ ਜਾ ਕੇ ਅਸੀਂ ਕਈ ਵਾਰੀ ਕੋਈ ਚੀਜ਼ ਆਪਣਾ ਖਾ ਲਈ ਉੱਥੇ ਜਾਂ ਕੋਈ ਇੱਕ ਦੂਜੇ ਨੂੰ ਹਾਸਾ ਮਜ਼ਾਕ ਕਰ ਲਿਆ ਤਾਂ ਜੋ ਉਹਨਾਂ ਦੇ ਦਿਲ ਨੂੰ ਆਪਣਾ ਮਿਠ ਮਿਠਾਸ ਪਹੁੰਚੇ ਅਤੇ ਇੱਦਾਂ ਉਹਨਾਂ ਦਾ ਮਨ ਵੀ ਹੋਰ ਤਰੋ ਤਾਜ਼ਾ ਹੋ ਸਕੇ ਤਾਂ ਜੋ ਦਿਮਾਗ 'ਚ ਕੋਈ ਟੈਂਸ਼ਨ ਨਾ ਉਹਨਾਂ ਨੂੰ ਰਹੇ ਅਸੀਂ ਤਾਂ ਇਹ ਇੱਦਾਂ ਹਾਸਾ ਮਜ਼ਾਕ ਕਰੀਦਾ ਕਿ ਬੰਦੇ ਨੂੰ ਮਹਿਸੂਸ ਹੀ ਨਾ ਹੋਵੇ ਕਿ ਸਾਡੇ ਦਿਮਾਗ 'ਤੇ ਕੋਈ ਟੈਨਸ਼ਨ ਹੈ ਜਾਂ ਕੁਛ ਹੋਰ ਹੈ ਜਾਂ ਖਾਣ ਪੀਣ ਅਸੀਂ ਘਰ ਬਹਿ ਕੇ ਬਣਾ ਲਿਆ ਫਿਰ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰ ਲਈਆਂ ਇੱਦਾਂ ਫੈਮਿਲੀ ਦਾ ਵਧੀਆ ਮਨ ਖੁਸ਼ ਹੋ ਜਾਂਦਾ ਤਾਂ ਜੋ ਉਹਨਾਂ ਨੂੰ ਇੱਦਾਂ ਦੀ ਕੋਈ ਗੱਲ ਮਹਿਸੂਸ ਨਾ ਹੋਵੇ